ਟੈਕਨੋਲੋਜੀ ਕਾਰਨ ਬਿਰਦਾਂ ਅਤੇ ਦ੍ਰਿਸ਼ਟੀਹੀਣਾਂ ਨੂੰ ਕਾਫ਼ੀ ਮਦਦ ਮਿਲੀ ਹੈ ਹੁਣ ਜਿਹੜੇ ਦ੍ਰਿਸ਼ਟੀਹੀਣ ਲੋਕ ਸਨ ਉਹਨਾਂ ਨੂੰ ਪੜ੍ਹਨ ਲਈ ਬਰੇਲ ਦਾ ਯੂਜ ਕਰਨਾ ਪੈਂਦਾ ਸੀ ਹੁਣ ਟੈਕਨੋਲੋਜੀ ਨਾਲ ਉਹ ਲਿਖਿਤ ਲਿਟਰੇਚਰ ਨੂੰ ਪੜ੍ਹ ਕੇ ਸੁਣ ਸਕਦੇ ਹਨ ਉਹ ਟੈਕਨੋਲੋਜੀ ਬੋਲਦੀ ਹੈ ਅਤੇ ਉਹ ਸੁਣਦੇ ਨੇ ਅਤੇ ਕੋਈ ਵੀ ਅਗਰ ਉਹਨਾਂ ਨੂੰ ਗੱਲਬਾਤ ਕਰਨੀ ਹੁੰਦੀ ਹੈ ਜਾਂ ਸਮਝਣਾ ਹੁੰਦਾ ਹੈ ਤਾਂ ਟੈਕਨੋਲੋਜੀ ਉਹਦੇ 'ਚ ਵੀ ਬਹੁਤ ਹੈਲਪ ਕਰ ਰਹੀ ਹੈ ਜਿਵੇਂ ਕਿ ਬੀ ਮਾਈ ਆਈ ਐਪ ਜਿਹਦੇ ਨਾਲ ਤੁਸੀਂ ਫੋਨ ਨੂੰ ਯੂਜ ਕਰ ਸਕਦੇ ਹੋ ਅਤੇ ਫੋਨ ਤੁਹਾਨੂੰ ਦੱਸਦਾ ਰਹੇਗਾ ਕਿ ਆਸੇ ਪਾਸੇ ਕੀ ਪਿਆ ਹੈ ਤਾਂ ਇੱਕ ਤਰੀਕੇ ਨਾਲ ਅੱਖਾਂ ਦੀ ਬਜਾਏ ਕੰਨਾਂ ਦਾ ਉਪਯੋਗ ਦੇ ਨਾਲ ਉਹ ਆਪਣੀ ਜ਼ਿੰਦਗੀ ਸੌਖੀ ਜੀਅ ਸਕਦੇ ਹਨ